ਸਾਡੇ ਇਲਾਕੇ ਵਿੱਚ ਕਈ ਤਰ੍ਹਾਂ ਦੇ ਅਪਰਾਧ ਦੇਖਣ ਨੂੰ ਮਿਲ ਰਹੇ ਹਨ ਇਹ ਸਭ ਬੇਰੁਜ਼ਗਾਰੀ ਕਾਰਨ ਹੀ ਹਨ ਇਹਨਾਂ ਵਿੱਚੋਂ ਇੱਕ ਹੈ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਇੱਕ ਖਤਰਨਾਕ ਹਮਲਾ ਹੈ ਜਿਸ ਦਾ ਕਿਸੇ ਕੰਪਨੀ ਜਾਂ ਵਿਅਕਤੀ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੇ ਬਹੁਤ ਸਾਰੇ ਮਾਮਲੇ ਹਨ ਜਿੱਥੇ ਸਾਈਬਰ ਹਮਲੇ ਨੇ ਡਾਟਾ ਹੈਕ ਹੋਣ ਕਾਰਨ ਕੰਪਨੀ ਅਤੇ ਵਿਅਕਤੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਸੀਂ ਇੱਕ ਟੈਕਨੋਲੋਜੀ ਸੰਚਾਲਿਤ ਯੁੱਗ ਵਿੱਚ ਰਹਿੰਦੇ ਹਾਂ ਅਤੇ ਜਾਣਕਾਰੀ ਦਾ ਹਰ ਹਿੱਸਾ ਹੁਣ ਕੰਪਿਊਟਰਾਂ 'ਤੇ ਫੀਡ ਕੀਤਾ ਜਾਂਦਾ ਹੈ ਅਸਲ ਦੁਨੀਆ ਦੇ ਸਮਾਨ ਜਿੱਥੇ ਅਪਰਾਧੀ ਜਾਇਦਾਦ ਚੋਰੀ ਕਰਦੇ ਹਨ ਸਾਈਬਰ ਸੰਸਾਰ ਵਿੱਚ ਹਮਲਾਵਰ ਡਾਟਾ ਚੋਰੀ ਕਰਦੇ ਹਨ ਇੱਥੇ ਹਮਲਾਵਰ ਇੱਕ ਵਿਅਕਤੀ ਦੇ ਬੈਂਕ ਵੇਰਵੇ ਚੋਰੀ ਕਰਦਾ ਹੈ ਅਤੇ ਔਨਲਾਈਨ ਖਰੀਦਦਾਰੀ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਖਤਰਨਾਕ ਸੋਫਟਵੇਅਰ ਦੀ ਵਰਤੋਂ ਕਰਕੇ ਉਹ ਸਭ ਚੋਰੀ ਕਰਦਾ ਹੈ ਸਰਕਾਰ ਨੂੰ ਇਹਨਾਂ 'ਤੇ ਰੋਕ ਲਾਉਣੀ ਚਾਹੀਦੀ ਹੈ ਅਤੇ ਕੋਈ ਵੱਡਾ ਸਟੈਪ ਚੱਕਣਾ ਚਾਹੀਦਾ ਹੈ